ਸਾਡੇ ਇਲਾਕੇ ਵਿੱਚ ਸਭ ਤੋਂ ਮਸ਼ਹੂਰ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਅੰਮ੍ਰਿਤਸਰ ਦੇ ਵਿੱਚ ਇਹ ਸਥਿੱਤ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਗੁਰਪੁਰਬ 'ਤੇ ਉੱਪਰ ਸਥਾਪਿਤ ਕੀਤੀ ਗਈ ਸੀਗੀ ਉੱਨੀ ਸੌ ਉਣੱਤਰ ਦੇ ਵਿੱਚ ਉਦੋਂ ਤੋਂ ਇਹ ਯੂਨੀਵਰਸਿਟੀ ਵਿੱਦਿਆ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਆ ਮੇਰੇ ਪਰਿਵਾਰ ਵਿੱਚੋਂ ਤਾਂ ਨਹੀਂ ਪਰ ਮੈਂ ਆਪਣੀ ਜਿਹੜੀ ਵਿੱਦਿਆ ਵਾ ਇਸ ਯੂਨੀਵਰਸਿਟੀ ਦੇ ਵਿੱਚੋਂ ਪ੍ਰਾਪਤ ਕਰ ਰਿਹਾ ਇਹਨਾਂ ਦਿਨਾਂ ਵਿੱਚ ਮੈਂ ਆਪਣੀ ਪੀਐਚਡੀ ਦੀ ਵਿੱਦਿਆ ਜਿਹੜੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਿਲ ਕਰ ਰਿਹਾ ਸੋ ਨੈਕ ਵੱਲੋਂ ਵੀ ਏ ਪਲਸ ਪਲਸ ਗ੍ਰੇਡ ਜਿਹੜਾ ਇਸ ਯੂਨੀਵਰਸਿਟੀ ਨੂੰ ਪ੍ਰਾਪਤ ਹੋਇਆ ਹੋਰ ਬਹੁਤ ਸਾਰੀਆਂ ਜਿਹੜੀਆਂ ਉਪਲੱਬਧੀਆਂ ਜਾਂ ਪ੍ਰਾਪਤੀਆਂ ਇਸ ਯੂਨੀਵਰਸਿਟੀ ਦੀਆਂ ਲੰਬੇ ਸਮੇਂ ਤੋਂ ਰਹੀਆਂ ਨੇ ਅਤੇ ਇਹ ਯੂਨੀਵਰਸਿਟੀ ਮਾਝੇ ਦੇ ਇਲਾਕੇ ਦੇ ਵਿੱਚ ਇਕਲੌਤੀ ਯੂਨੀਵਰਸਿਟੀ ਆ ਜਿਹੜੀ ਬੜੇ ਸੋਹਣੇ ਢੰਗ ਦੇ ਨਾਲ ਕਾਰਜਸ਼ੀਲ ਆ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਇੱਥੇ ਆਪਣੀ ਵਿੱਦਿਆ ਹਾਸਿਲ ਕਰ ਰਹੇ ਨੇ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੱਡੀ ਗੱਲ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਪਰ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਆ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਪ੍ਰਸਾਰਨ ਦੇ ਲਈ ਨੌਜਵਾਨਾਂ ਦੇ ਵਿੱਚ ਇੱਕ ਸੋਹਣੀ ਭਾਵਨਾ ਜਿਹੜੀ ਉਹ ਪੈਦਾ ਕਰਨ ਦੇ ਲਈ ਇਹ ਯੂਨੀਵਰਸਿਟੀ ਯਤਨਸ਼ੀਲ ਹੈ ਅਤੇ ਇੱਥੇ ਪੜ੍ਹ ਕੇ ਇੱਥੇ ਰਹਿ ਕੇ ਰੂਹ ਨੂੰ ਸਕੂਨ ਵੀ ਮਿਲਦਾ ਖੁਸ਼ੀ ਵੀ ਹੁੰਦੀ ਆ